ਅੱਜ ਕੱਲ੍ਹ ਐਂਡਰੋਇਡ ਫੋਨ ਦੇ ਵਿੱਚ ਨਾ ਕਾਫ਼ੀ ਸਾਰੀ ਐਪਸ ਆ ਰਹੀਆਂ ਨੇ ਜਿਹੜੀ ਤੁਹਾਨੂੰ ਰੋਜ਼ਾਨਾ ਯੂਜ਼ ਦੇ ਵਿੱਚ ਯੂਜ਼ ਹੁੰਦੀਆਂ ਨੇ ਜਿਵੇਂ ਕਿ ਗੱਲ ਕਰੀਏ ਜੇ ਆਪਾਂ ਕਰ ਆਪਾਂ ਹੈਲਥ ਰਿਲੇਟਿਡ ਐਪਸ ਹੈ ਨੇ ਤਾਂ ਉਹ ਨਾ ਅਸੀਂ ਆਪਣੀ ਹੈਲਥ ਨੂੰ ਪ੍ਰਤੀ ਬਹੁਤ ਜਾਗੂਰਕ ਕਰਦੀਆਂ ਨੇ ਸਾਨੂੰ ਨਵੀਂ ਐਕਸਰਸਾਈਜ਼ ਦੱਸਦੀਆਂ ਨੇ ਅਤੇ ਜੇਕਰ ਕੋਈ ਅਸੀਂ ਔ ਔਡਰ ਘਰ ਬੈਠੇ ਕੋਈ ਖਾਣ ਵਾਸਤੇ ਮੰਗਾਉਣਾ ਹੈ ਸਵਿਗੀ ਐਪ ਹਾਂ ਜਾਂ ਜ਼ੋਮੈਟੋ ਹਾਂ ਤਾਂ ਅਸੀਂ ਘਰ ਬੈਠੇ ਅਸੀਂ ਕਿੰਨੇ ਵੀ ਦੂਰ ਬੈਠੇ ਹਾਂ ਤਾਂ ਅਸੀਂ ਖਾਣ ਨੂੰ ਕੁਛ ਵੀ ਆਪਣਾ ਮੰਗਵਾ ਸਕਦੇ ਨੇ